ਸਤਿ ਸ਼੍ਰੀ ਅਕਾਲ ਜੀ ਫਲਿੱਪਕਾਰਟ ਤੋਂ ਬੋਲਦੇ ਮੈਂ ਨਾਂ ਕੁਝ ਦਿਨ ਪਹਿਲਾਂ ਓਡਰ ਕੀਤਾ ਸੀਗਾ ਬੋਟ ਦੇ ਹੈੱਡਫੋਨ ਮੰਗਵਾਏ ਸੀਗੇ ਉਨ੍ਹਾਂ ਦੀ ਪੈਕੇਜਿੰਗ ਬਹੁਤ ਵਧੀਆ ਸੀਗੀ ਅਤੇ ਉਨ੍ਹਾਂ ਦੀ ਸਾਊਂਡ ਕੁਆਲਿਟੀ ਉਹ ਤਾਂ ਉਸ ਤੋਂ ਵੀ ਉੱਤੇ ਆ ਅਤੇ ਬੈਟਰੀ ਬੈਕਅੱਪ ਬੈਟਰੀ ਵੀਹ ਘੰਟੇ ਤੋਂ ਵਧ ਦੇ ਰਿਹਾ ਅਤੇ ਮੈਂ ਉਸ ਨਾਲ ਇੰਨਾ ਖੁਸ਼ ਹਾਂ ਕਿ ਤੁਸੀਂ ਪੁੱਛੋ ਨਾ ਸੋ ਇਹ ਸਾਰਾ ਕੁਛ ਭੇਜਣ ਲਈ ਧੰਨਵਾਦ ਤੁਹਾਡਾ